ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਜਦੋਂ ਮੈਂ ਬਹੁਤ ਜ਼ਿਆਦਾ ਅਣਉਚਿਤ ਮਹਿਸੂਸ ਕਰਦੀ ਹਾਂ ਤਾਂ ਮੈਂ ਪੇਂਟਿੰਗ ਕਰਨਾ ਸ਼ੁਰੂ ਕਰ ਦਿੰਦੀ ਹਾਂ ਜਦੋਂ ਵੀ ਮੇਰੇ ਦਿਮਾਗ ਦੇ ਵਿੱਚ ਕੋਈ ਬਹੁਤ ਜ਼ਿਆਦਾ ਖਰਾਬ ਘਟਣਾ ਚੱਲਦੀ ਹੈ ਤਾਂ ਮੈਂ ਪੇਂਟਿੰਗ ਕਰਨਾ ਸ਼ੁਰੂ ਕਰ ਦਿੰਦੀ ਹਾਂ ਅਤੇ ਮੇਰਾ ਦਿਮਾਗ ਸ਼ਾਂਤ ਹੋ ਜਾਂਦਾ ਹੈ ਮੈਂ ਜਦੋਂ ਵੀ ਪੇਂਟ ਕਰਦੀ ਹਾਂ ਤਾਂ ਮੈਂ ਬਹੁਤ ਖੁਸ਼ ਹੁੰਦੀ ਹਾਂ ਜਦੋਂ ਮੈ ਜੋ ਜੋ ਵੀ ਮੈਂ ਪੇਂਟਿੰਗ ਕਰਦੀ ਹਾਂ ਜਦੋਂ ਮੈਂ ਉਹਨਾਂ ਨੂੰ ਰ ਪੇਂਟ ਰੰਗ ਭਰਦੀ ਹਾਂ ਉਹਨਾਂ ਵਿੱਚ ਤਾਂ ਕਲਰਫੁੱਲ ਰੰਗਾਂ ਨੂੰ ਵੇਖ ਕੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਪੇਂਟ ਕਰਨਾ ਮੇਰਾ ਇੱਕ ਸੁਭਾਅ ਹੈ ਅਤੇ ਮੈਨੂੰ ਬਹੁਤ ਪਸੰਦ ਹੈ